ਲਾਭ ਹਨ ਤਾਂ ਕਿ ਜਦੋਂ ਅਸੀਂ ਮੀਡੀਆ ਵਿੱਚ ਦਿਖਾਏ ਜਾਂਦੇ ਨੇ ਇਸ਼ਤਿਆਰ ਇਹ ਸਾਨੂੰ ਪਤਾ ਚੱਲਦਾ ਹੈ ਕਿ ਕਿੱਥੇ ਕਿੱਥੇ ਕੀ ਹੋ ਰਿਹਾ ਕੀ ਚੱਲ ਰਿਹਾ ਹੈ ਕੀ ਕਿੱਥੇ ਕਿੱਥੇ ਸੇਲ ਲੱਗੀ ਹੈ ਕੁਛ ਅੱਛੀਆਂ ਚੀਜ਼ਾਂ ਬਾਰੇ ਪਤਾ ਚੱਲਿਆ ਕੁਛ ਬੁਰੀਆਂ ਚੀਜ਼ਾਂ ਬਾਰੇ ਚਲਦਾ ਹੈ ਇਹਨੇ ਸਾਨੂੰ ਬਹੁਤ ਹੀ ਲਾਭ ਹਨ ਸਾਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਅੱਛੀ ਚੀਜ਼ ਹੈ ਜੋ ਮੀਡੀਆ ਸਾਨੂੰ ਇਹਦੇ ਵਿੱਚ ਮੀਡੀਆ ਵਿੱਚ ਦਿਖਾਏ ਜਾਣ ਨਾਲ ਸਾਰਾ ਕੁਝ ਪਤਾ ਚੱਲਦਾ ਸਾਡਾ ਇਹ ਵਿਚਾਰ ਹ ਕਿ ਮੀਡੀਆ ਵਾਲੇ ਦੁਨੀਆਂ ਨੂੰ ਦੁਨੀਆਂ ਭਰ ਦੀ ਖਬਰਾਂ ਘਰ ਬੈਠੇ ਹੀ ਪਹੁੰਚਾ ਦਿੰਦੇ ਹਨ ਮੀਡੀਆ ਇੱਕ ਬਹੁਤ ਹੀ ਅੱਛੀ ਚੀਜ਼ ਹੈ